ਹੈਲੋ ਮੈਂ ਨਾ ਇੱਕ ਪ੍ਰੋਡਕਟ ਮੰਗਾਇਆ ਸੀ ਜਿਹੜਾ ਕਿ ਹੋਮ ਵ ਦੇ ਵਿੱਚ ਟੂਲ ਸੀਗਾ ਇੱਕ ਜਿਹੜਾ ਕਿ ਮੈਨੂੰ ਅੱਛਾ ਨਹੀਂ ਲੱਗਿਆ ਅਤੇ ਇਹਦਾ ਬਹੁਤ ਨੈਗੇਟਿਵ ਐਕਸਪੀਰੀਅੰਸ ਰਿਹਾ ਨੈਗੇਟਿਵ ਐਕਸਪੀਰੀਅੰਸ ਇਹ ਰਿਹਾ ਵੀ ਉਹ ਪ੍ਰੋਡਕਟ ਜਦੋਂ ਇੱਕ ਜਦੋਂ ਲੈ ਕੇ ਆਇਆ ਸੀ ਆਪਣਾ ਡਿਲੀਵਰੀ ਬੋਆਏ ਤਾਂ ਉਹ ਇੱਕ ਤਾਂ ਥੋੜ੍ਹਾ ਜਿਹਾ ਡਿਫੈਕਟਿਵ ਸੀ ਡਿਫੈਕਟਿਵ ਇਸ ਕਾਰਨ ਸੀ ਉਹਦਾ ਕੋਈ ਬਾਕਸ ਖੁੱਲਿਆ ਹੋਇਆ ਸੀ ਅਤੇ ਬੋਕਸ ਦੇ ਵਿੱਚ ਕੁਛ ਪਾਰਟਸ ਉਹਦੇ ਮਿਸਿੰਗ ਵੀ ਸੀ ਅਤੇ ਚੱਲੋ ਅਸੀਂ ਐਕਸੈਪਟ ਕਰ ਲਿਆ ਐਕਸੈਪਟ ਕਰਨ ਤੋਂ ਬਾਅਦ ਫਿਰ ਅਸੀਂ ਉਸਨੂੰ ਵਰਤ ਕੇ ਜਦੋਂ ਅਸੀਂ ਉੱਪਰ ਕਿਚਨ 'ਚ ਲੈ ਕੇ ਗਏ ਅਤੇ ਜਦੋਂ ਅਸੀਂ ਇਹਨੂੰ ਵਰਤਿਆ ਵਰਤਣ ਤੋਂ ਬਾਅਦ ਸਾਨੂੰ ਉਹ ਮਤਲਬ ਕੀ ਆਪਰੇਸ਼ਨਲ ਨਹੀਂ ਲੱਗਿਆ ਸਾਨੂੰ ਡਾਊਟ ਤਾਂ ਪਹਿਲਾਂ ਹੀ ਸੀ ਵੀ ਇਹ ਸ਼ਾਇਦ ਆਪਰੇਸ਼ਨਲ ਨਾ ਹੋਵੇ ਪਰ ਅਸੀਂ ਕਿਹਾ ਚੱਲੋ ਇੱਕ ਵਾਰੀ ਮੰਗਵਾਇਆ ਤਾਂ ਇਹਨੂੰ ਚੈੱਕ ਕਰ ਲੈਣਾ ਚਾਹੀਦਾ ਤਾਂ ਕਿ ਕੰਪਨੀ ਦਾ ਕੋਈ ਨੁਕਸਾਨ ਨਾ ਹੋਵੇ ਅਤੇ ਸਾਡੇ ਤਾਂ ਵੀ ਕੋਈ ਨੁਕਸਾਨ ਨਾ ਹੋਵੇ ਫਿਰ ਇਸਨੂੰ ਚੈੱਕ ਕਰਕੇ ਦੇਖਿਆ ਤਾਂ ਚੈੱਕ ਕਰਨ ਤੋਂ ਬਾਅਦ ਸਾਨੂੰ ਇਹ ਪਤਾ ਲੱਗਿਆ ਵੀ ਇਹ ਪ੍ਰੋਡਕਟ ਠੀਕ ਨਹੀਂ ਹੈ ਅਤੇ ਇਹ ਫਿਰ ਅਸੀਂ ਮਤਲਬ ਬਹੁਤ ਵਧੀਆ ਕੰਪਨੀ ਤੋਂ ਇਹ ਮੰਗਵਾਇਆ ਸੀ ਮੰਗਵਾਉਣ ਤੋਂ ਬਾਅਦ ਫਿਰ ਸਾਨੂੰ ਇੰਨਾ ਉਮੀਦ ਨਹੀਂ ਸੀ ਵੀ ਇਹ ਪ੍ਰੋਡਕਟ ਇੰਨਾ ਖਰਾਬ ਨਿਕਲੇਗਾ ਬਟ ਉਹ ਪ੍ਰੋਡਕਟ ਇੰਨਾ ਖਰਾਬ ਨਿਕਲਿਆ ਵੀ ਸਾਨੂੰ ਅਸੀਂ ਪ੍ਰੋਪਰਲੀ ਉਹਨੂੰ ਹੈਂਡਲ ਨਹੀਂ ਕਰ ਪਾਏ ਅਤੇ ਸਾਨੂੰ ਮੁੜ ਕੇ ਹਾਰ ਕੇ ਉਹਨੂੰ ਵਾਪਸ ਹੀ ਕਰਨਾ ਪਿਆ ਵਾਪਸ ਕਰਨ ਦਾ ਫਿਰ ਅਸੀਂ ਉਹਨਾਂ ਨੂੰ ਕਸਟਮਰ ਕੇਅਰ ਨੂੰ ਕੋਲ ਕੀਤੀ ਉੱਥੇ ਪ੍ਰੋਡਕਟ ਕੈਸਲੇਸ਼ਨ ਦੀ ਰਿਕੁਐਸਟ ਪਾਈ ਰਿਕੁਐਸਟ ਪਾ ਕਰਨ ਤੋਂ ਬਾਅਦ ਫਿਰ ਉਹ ਡ ਡਿਲੀਵਰੀ ਬੋਆਏ ਵਾਪਸ ਆਇਆ ਉਸ ਪ੍ਰੋਡਕਟ ਨੂੰ ਚੈੱਕ ਕਰਕੇ ਉਹਨੇ ਪ੍ਰੋਪਰ ਪੈਕ ਕਰਕੇ ਉਸਨੇ ਉਸਨੂੰ ਵਾਪਸ ਭੇਜ ਦਿੱਤਾ ਅਤੇ ਕੁਛ ਦੇਰ ਬਾਅਦ ਫਿਰ ਸਾਨੂੰ ਉਹਦਾ ਰਿਫੰਡ ਵੀ ਵਾਪਸ ਮਿਲ ਗਿਆ ਸੀ ਅਤੇ ਇਹੀ ਚਾਹੁੰਦੇ ਹਾਂ ਵੀ ਕੰਪਨੀ ਅੱਗੇ ਤੋਂ ਇਹ ਪ੍ਰੋਡਕਟਸ ਇੱਦਾਂ ਦੇ ਨਾ ਹੀ ਵੇਚਿਆ ਕਰੇ ਤਾਂ ਬ ਬੈਡ ਇਮਪਰੈਸ਼ਨ ਕੰਪਨੀ ਦਾ ਪ੍ਰੋਡਕਟ ਪ੍ਰੋਡਕਟਸ ਜਿਹੜੇ ਲੈਣ ਵਾਲੇ ਗ੍ਰਾਹਕ ਨੇ ਉਹਨਾਂ ਦੇ ਉੱਪਰ ਵੀ ਪੈਂਦਾ ਹੈ